ਅੱਜ ਕੱਲ੍ਹ ਸਭ ਕੁਛ ਹੀ ਡਿਜੀਟਲ ਹੋ ਗਿਆ ਹੈ ਜੇ ਅੱਜ ਕੱਲ੍ਹ ਦੀ ਗੱਲ ਦੇਖੀਏ ਤਾਂ ਅੱਜ ਕੱਲ੍ਹ ਲੋਕ ਵੀ ਡਿਜੀਟਲ ਹੋ ਗਏ ਹਨ ਰਿਸ਼ਤੇ ਵੀ ਡਿਜੀਟਲ ਹੋ ਗਏ ਹਨ ਇਹ ਮੈਂ ਈਵਨ ਕਿ ਮੇਲ ਮਿਲਾਪ ਵੀ ਡਿਜੀਟਲ ਹੋ ਗਏ ਹਨ ਸੋ ਜੇ ਆਪਾਂ ਡਿਜੀਟਲ ਕਲਾ ਦੀ ਗੱਲ ਕਰੀਏ ਤਾਂ ਡਿਜੀਟਲ ਕਲਾ ਬਹੁਤ ਚੰਗੀ ਹੈ ਪਰ ਇਸ ਡਿਜੀਟਲ ਕਲਾ ਨੇ ਸਾਡੀ ਜਿਹੜੀ ਆਪ ਦੀ ਮਨੁੱਖੀ ਕਲਾ ਹੈ ਉਹ ਕਿਤੇ ਨਾ ਕਿਤੇ ਹੈ ਜਿਹੜੀ ਉਹ ਦਬਾਣੀ ਸ਼ੁਰੂ ਕਰ ਦਿੱਤੀ ਹੈ ਸੋ ਜਿਹੜੀ ਮਨੁੱਖ ਦੀ ਆਪ ਦੀ ਕ੍ਰੀਏਟਿਵਿਟੀ ਹੈ ਉਹ ਡਿਜੀਟਲ ਕਲਾ ਦੇ ਨੀਚੇ ਆ ਕੇ ਕਿਤੇ ਨਾ ਕਿਤੇ ਦੱਬਣੀ ਸ਼ੁਰੂ ਹੋ ਗਈ ਹੈ ਮਨੁੱਖ ਹੈ ਜਿਹੜਾ ਉਹ ਆਪਣੀ ਕ੍ਰਿਟੀਵਿਟੀ ਆਪਣੀ ਥਿੰਕਿੰਗ ਪ੍ਰੋਸੈਸਿਜ਼ ਨੇ ਜਿਹੜੇ ਉਹਨਾਂ ਨੇ ਉਹ ਘੱਟ ਕਰਤੇ ਇਸ ਕਰਕੇ ਉਹ ਥਿੰਕਿੰਗ ਪ੍ਰੋਸੈਸਿਜ਼ ਥੋਟ ਪ੍ਰੋਸੈਸਿਜ਼ ਨੇ ਜਿਹੜੀਆ ਉਸ ਤਰੀਕੇ ਦੇ ਨਾਲ ਕੰਮ ਹੀ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਹੈ ਕਿ ਇਹ ਕੰਮ ਤਾ ਜੀ ਫੋਨ ਦੀ ਹੈਲਪ ਨਾਲ ਹੋ ਜਾਣਾ ਇਹ ਕੰਮ ਤਾਂ ਜੀ ਅਸੀਂ ਇੰਟਰਨੈਟ ਦੀ ਹੈਲਪ ਨਾਲ ਕਰ ਲੈਣਾ ਸੋ ਮਨੁੱਖੀ ਕਲਾ ਹੈ ਜਿਹੜੀ ਉਹ ਜ਼ਿਆਦਾ ਵਧੀਆ ਹੁੰਦੀ ਸੀਗੀ ਡਿਜੀਟਲ ਕਲਾ ਦੇ ਨਾਲੋਂ ਕਿਉਂ ਕਿਉਂਕਿ ਸਾਡੀ ਕਲਾ ਦੇ ਵਿੱਚ ਸਾਡੇ ਆਪ ਦੇ ਅਨੁਭਵ ਸਾਡੇ ਆਪਦੇ ਇਮੋਸ਼ਨਜ਼ ਸਾਡੇ ਆਪਦੇ ਤਜਰਬੇ ਨੇ ਜਿਹੜੇ ਉਹ ਕਿਤੇ ਨਾ ਕਿਤੇ ਜੁੜੇ ਹੁੰਦੇ ਸੀਗੇ ਜਿਹੜੇ ਕਿ ਡਿਜੀ ਡਿਜੀਟਲ ਕਲਾ ਦੇ ਵਿੱਚ ਉਹ ਨਹੀਂ ਜੁੜੇ ਹੋਏ ਹੈਗੇ ਸੋ ਅਫਸੋਸ ਹੀ ਹੈ ਕਿ ਮਨੁੱਖੀ ਕਲਾ ਹੈ ਜਿਹੜੀ ਉਹ ਡਿਜੀਟਲ ਕਲਾ ਦੇ ਉੱਤੇ ਭਾਰੂ ਨਹੀਂ ਹੋ ਪਾ ਰਹੀ ਹੈਗੀ ਡਿਜੀਟਲ ਕਲਾ ਦਾ ਜ਼ਮਾਨਾ ਜਿਹੜਾ ਉਹ ਜ਼ਿਆਦਾ ਚੱਲ ਰਿਹਾ ਹੈ